ਉਂਝ ਤਾਂ ਮੈਂ ਬਹੁਤ ਸਾਰੀਆਂ ਰੈਸਿਪੀਸ ਬਣਾਉਂਦੀਆਂ ਰਹਿੰਦੀ ਬਣਾਉਂਦੀ ਰਹਿੰਦੀ ਹਾਂ ਬਟ ਮੈਂ ਅੱਜ ਕੁਛ ਰੈਸਿਪੀਆਂ ਹੈਗੀਆਂ ਜੋ ਮੈਂ ਬਣਾਈਆਂ ਵੀ ਆ ਅਤੇ ਜੇਕਰ ਕਿਤੇ ਨਾ ਕਿਤੇ ਖਰਾਬ ਹੋ ਜਾਣ ਉਹਨਾਂ ਨੂੰ ਸਹੀ ਕਰਨ ਦੇ ਲਈ ਜੋ ਸਾਡੇ ਕੋਲ ਨੁਸਖ਼ੇ ਹੈ ਉਹ ਵੀ ਵਰਤਦੇ ਹਾਂ ਆਪਾਂ ਅਤੇ ਉ ਉਹਨਾਂ ਦੇ ਨਾਲ ਨਾਲ ਮੈਂ ਤੁਹਾਨੂੰ ਉਹ ਨੁਸਖ਼ੇ ਵੀ ਦੱਸਾਂਗੀ ਕਿ ਅਸੀਂ ਕਿਹੜੇ ਕਿਹੜੇ ਨੁਸਖ਼ੇ ਅਪਣਾ ਸਕਦੇ ਹਾਂ ਉਹਨਾਂ ਰੈਸਿਪੀਆਂ ਨੂੰ ਠੀਕ ਕਰਨ ਦੇ ਲਈ ਪਹਿਲੀ ਰੈਸਿਪੀ ਹੈਗੀ ਹੈ ਇਡਲੀ ਦੀ ਇਡਲੀ ਬਣਾਉਣ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਸੂਜੀ ਚਾਹੀਦੀ ਹੁੰਦੀ ਆ ਸੂਜੀ ਸਾਡੇ ਕੋਲ ਮੋਟੀ ਸੂਜੀ ਦੀ ਜ਼ਰੂਰਤ ਹੈ ਨਾ ਕਿ ਬਰੀਕ ਸੂਜੀ ਅਤੇ ਜੇਕਰ ਅਸੀਂ ਇਹ ਸਾਡੇ 'ਤੇ ਹੁੰਦਾ ਆ ਕਿ ਅਸੀਂ ਕਿੱਦਾਂ ਦਾ ਸੁਆਦ ਸਾਡੇ ਕਿੱਦਾਂ ਦਾ ਸਵਾਦ ਅਸੀਂ ਚਾਹੁੰਦੇ ਹਾਂ ਅਤੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਜਿਹੜੀ ਇਡਲੀ ਬਣਾਉਣੀ ਹੈ ਹੈਵੀ ਬਣਾਉਣੀ ਹੈ ਠੀਕ ਆ ਤਾਂ ਅਸੀਂ ਕੀ ਕਰ ਸਕਦੇ ਉਹਦੇ ਵਿੱਚ ਕਾਜੂ ਬਦਾਮ ਪਾ ਸਕਦੇ ਹਾਂ ਸਾਡੇ ਕੋਲ ਹੋਰ ਪਿਸਤਾ ਹੋ ਗਿਆ ਉਹ ਪਾ ਸਕਦੇ ਹਾਂ ਅਸੀਂ ਉਹਦੇ ਵਿੱਚ ਕੀ ਕਰਨਾ ਆ ਜਿਹੜੀ ਸਾਡੇ ਕੋਲ ਰਾਈ ਹੁੰਦੀ ਆ ਉਹਦੇ ਵਿੱਚ ਰਾਈ ਪਾਉਣੀ ਆ ਧਨੀਏ ਦੇ ਪੱਤੇ ਕੱਟ ਕੇ ਪਾਉਣੇ ਹੈ ਲੂਣ ਪਾਉਣਾ ਉਪਰ ਉਹ ਪਾਉਣਾ ਹਲਕਾ ਜਿਹਾ ਇਸ ਵਿੱਚ ਅਸੀਂ ਮਿਰਚ ਦਾ ਸ ਜਿਹੜਾ ਸੇਵਨ ਸ ਮਿਰਚ ਮਿਰਚ ਦਾ ਜਿਹੜਾ ਮਿਰਚ ਨੂੰ ਐਡ ਬਿਲਕੁਲ ਵੀ ਨਹੀਂ ਕਰਨਾ ਹੈਗਾ ਇਹ ਦੇ ਵਿੱਚ ਅਤੇ ਉਸ ਤੋਂ ਬਾਅਦ ਅਸੀਂ ਕੀ ਕਰਨਾ ਆ ਸਭ ਤੋਂ ਜ਼ਿਆਦਾ ਜ਼ਰੂਰੀ ਇਹਦੇ ਲਈ ਦਹੀਂ ਹੁੰਦਾ ਆ ਦਹੀਂ ਤੁਹਾਡੇ ਕੋਲ ਖੱਟਾ ਹੋਣਾ ਚਾਹੀਦਾ ਆ ਅਤੇ ਜਦੋਂ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰਨਾ ਆ ਮਿਕਸ ਕਰਕੇ ਅਸੀਂ ਜਿਹੜਾ ਦਹੀਂ ਆ ਉਹਨੂੰ ਮਿਕਸ ਕਰਕੇ ਸੂਜੀ ਦੇ ਵਿੱਚ ਜੋ ਅਸੀਂ ਹੋਰ ਬਾਕੀ ਸਮੱ ਸਮੱਗਰੀ ਸਾਡੀ ਲਈ ਸੀਗੀ ਉਹਨਾਂ ਸਾਰਿਆਂ ਨੂੰ ਮਿਕਸ ਕਰਕੇ ਪੰਜ ਮਿੰਟ ਦੇ ਲਈ ਰੱਖ ਦੇਣਾ ਆ ਅਤੇ ਇਹਦੇ ਲਈ ਇੱਕ ਚੀਜ਼ ਹੁੰਦੀ ਆ ਕਿ ਅਸੀਂ ਸਾਨੂੰ ਇਹਦੇ ਲਈ ਕੋਈ ਤੇਲ ਵਗੈਰਾ ਦੀ ਜ਼ਰੂਰਤ ਜ਼ਿਆਦਾ ਨਹੀਂ ਹੁੰਦੀ ਹੈਗੀ ਜੇ ਤੁਹਾਡੇ ਕੋਲ ਕੜਛੀ ਕੁ ਤੇਲ ਹੈਗਾ ਹੈ ਤਾਂ ਉਹ ਬਹੁਤ ਹੁੰਦਾ ਹੈ ਇਹਦੇ ਲਈ

ਆਪਾਂ ਜਿਹੜਾ ਅਸੀਂ ਜ਼ਿਆਦਾਤਰ ਲੋਕ ਜਿ ਕੀ ਕਰਦੇ ਆ ਕਿ ਇਡਲੀ ਨੂੰ ਸਾਂਬਰ ਦੇ ਨਾਲ ਖਾਂਦੇ ਆ ਸਾਂਬਰ ਕਿੱਦਾਂ ਬਣਦਾ ਹੁਣ ਸਾਂਬਰ ਸਾਡੇ ਕੋਲ ਜਿਹੜੀ ਦਾਲ ਹੁੰਦੀ ਆ ਉੜਦ ਦਾਲ ਹੁੰਦੀ ਆ ਉੜਦ ਦਾਲ ਨੂੰ ਕੀ ਕਰਨਾ ਹੈ ਆਪਾਂ ਉੜਦ ਦਾਲ ਲੈ ਲੈਣੀ ਆ ਇੱਕ ਹੁੰਦੀ ਆ ਮਹਾਂ ਦੂਜੇ ਦੀ ਦਾਲ

ਆਪਾਂ ਲੂਣ ਵੀ ਪੂਰਾ ਕਰਨਾ ਹੈ ਪਰ ਖਾਣੀ ਵੀ ਸੁੱਕੀ ਆ ਅਤੇ ਆਪਾਂ ਕੀ ਕਰ ਸਕਦੇ ਹਾਂ ਆਪਾਂ ਪਿਆਜ ਕੱਟ ਕੇ ਅਤੇ ਬਾਕੀ ਸਬਜ਼ੀਆਂ ਵਿੱਚ ਪਾ ਕੇ ਹੋ ਉਹ ਨੂੰ ਇਡਲੀ ਨੂੰ ਥੋੜ੍ਹਾ ਜਿਹਾ ਹੋਰ ਮੋਡੀਫਾਈ ਕਰ ਸਕਦੇ ਹਾਂ ਮੀਨਸ ਇਡਲੀ ਇੱਕ ਆਪਣੀ ਸੁੱਕੀ ਹੋ ਜਾਉਗੀ ਇੱਕ ਉਹਦੇ ਵਿੱਚ ਕੋਈ ਤੇਲ ਨਹੀਂ ਭਰਿਆ ਹੋਊਗਾ ਸਾਡਾ ਲੂਣ ਵੀ ਜਿਹੜਾ ਆ ਕੀ ਹੋਊਗਾ ਉਹ ਪੂਰਾ ਹੋਊਗਾ ਅਤੇ ਦੂਜੀ ਮੈਂ ਜਿਹੜੀ ਰੈਸਿਪੀ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਗੀ ਚਿਕਨ ਦੀ ਜੇ ਆਪਾਂ ਚਿਕਨ ਬਣਾਉਂਦੇ ਆ ਸਭ ਤੋਂ ਪਹਿਲਾਂ ਤਾਂ ਜੇ ਹੁਣ ਅਸੀਂ ਇਹ ਸਾਰਾ ਕੁਛ ਸਾਡਾ ਜਿਹੜਾ ਹੁੰਦਾ ਚਿਕਨ 'ਤੇ ਡੀਪੈਂਡ ਹੁੰਦਾ ਹੈ ਆ ਕਿ ਤੁਸੀਂ ਚਿਕਨ ਕਿੰਨੇ ਕਿਲੋ ਲੈ ਰਹੇ ਹਾਂ ਜੇ ਤਾਂ ਤੁਸੀਂ ਇੱਕ ਕਿਲੋ ਚਿਕਨ ਲੈ ਰਹੇ ਹਾਂ ਤਾਂ ਤੁਹਾਡਾ ਉਹਦੇ ਵਿੱਚ

ਚਿਕਨ ਸਾਡਾ ਬਣ ਜਾਂਦਾ ਆ ਬਟ ਤੇਲ ਜ਼ਿਆਦਾ ਹੋ ਜਾਂਦਾ ਹੈ ਸਾਡੇ ਉਹਦੇ ਵਿੱਚ ਅਤੇ ਉਹ ਜ਼ਿਆਦਾ ਤੇਲ ਹੋਣ ਦੇ ਕਾਰਨ ਸਾਨੂੰ ਕੀ ਆ ਅਸੀਂ ਉਹਨੂੰ ਖਾ ਨਹੀਂ ਪਾਉਂਦੇ ਹੈਗੇ ਉੱਪਰ ਜਦੋਂ ਅਸੀਂ ਕੋਲੀ ਵਿੱਚ ਪਾਉਂਦੇ ਹਾਂ ਉਹ ਤੇਲ ਤੇਲ ਹੀ ਤਰਦਾ ਰਹਿੰਦਾ ਆ ਅਤੇ ਫਿਰ ਉਹ ਜਾ ਕੇ ਸਾਡੇ ਜਿਹੜਾ ਸਾਡਾ ਪਾਚਨ ਸਿਸਟਮ ਆ ਸਾਡਾ ਡਾਈਜਸਟਿਵ ਸਿਸਟਮ ਆ ਉਹਨੂੰ ਜਾ ਕੇ ਖ਼ਰਾਬ ਕਰਦਾ ਹੈ ਫਿਰ ਅਸੀਂ ਦਵਾਈਆਂ ਖਾਂਦੇ ਹਾਂ ਅਤੇ ਉਸ ਚੀਜ਼ ਨੂੰ